ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਿਹਾ ਅੱਛਾ ਅੱਛਾ ਠੀਕ ਆ ਤਾਂ ਕਿਸ ਤਰ੍ਹਾਂ ਬਣਾਉਣਾ ਆ ਅੱਛਾ ਹਾਂਜੀ ਅੱਛਾ ਅੱਛਾ ਠੀਕ ਆ ਹਾਂਜੀ ਅਤੇ ਸਾਡੇ ਹਾਂ ਸਾਡੇ ਵੀ ਪੰਜਾਬ 'ਚ ਇੱਧਰ ਬਹੁਤ ਘੁੰਮਣ ਵਾਲੀਆਂ ਜਗ੍ਹਾਵਾਂ ਹਨ ਜਿੱਦਾਂ ਅੰਮ੍ਰਿਤਸਰ ਨਕੋਦਰ ਵੈਸ਼ਨੂੰ ਮਾਤਾ ਆਗਰਾ ਕੁਤਬਮੀਨਾਰ ਵਗੈਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਬੂ ਹਾਂਜੀ ਓਕੇ ਥੈਂਕ ਯੂ